ਮੇਰੇ ਅਨੁਸਾਰ ਬੱਚਿਆਂ ਦੀ ਜਿਹੜੀ ਮੋਬਾਈਲ ਫੋਨ ਦੀ ਵਰਤੋਂ ਅੱਠਵੀਂ ਕਲਾਸ ਤੋਂ ਹੀ ਕਰਨੀ ਚਾਹੀਦੀ ਹੈ ਜਦੋਂ ਬੱਚੇ ਨੂੰ ਥੋੜ੍ਹੀ ਜਿਹੀ ਸਮਝ ਆਉਣੀ ਸ਼ੁਰੂ ਹੁੰਦੀ ਹੈ ਉਸ ਵੇਲੇ ਉਸਦੀ ਉਮਰ ਪੰਦਰਾਂ ਤੋਂ ਉੱਪਰ ਹੁੰਦੀ ਹੈ ਫਿਰ ਹੀ ਉਹ ਇੱਕ ਅੱਛੇ ਤਰੀਕੇ ਦੇ ਨਾਲ ਮੋਬਾਈਲ ਦੀ ਵਰਤੋਂ ਕਰ ਸਕਦਾ ਹੈ ਮੋਬਾਇਲ ਦੀ ਵਰਤੋਂ ਦੇ ਵਿੱਚ ਵਿੱਚ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਮਾਂ ਪਿਓ ਨੂੰ ਚਾਹੀਦਾ ਹੈ ਕਿ ਉਸ ਨੂੰ ਅੱਛੀਆਂ ਅੱਛੀਆਂ ਚੀਜ਼ਾਂ ਦੇ ਬਾਰੇ ਉਸਨੂੰ ਦੱਸਿਆ ਜਾਵੇ ਜਿਵੇਂ ਕਿ ਉਸ ਦੀ ਪੜ੍ਹਾਈ ਦੇ ਨਾਲ ਨਾਲ ਪੜ੍ਹਾਈ ਨੂੰ ਅੱਛੀ ਤਰ੍ਹਾਂ ਨਾਲ ਸੁਚਾਰੂ ਢੰਗ ਦੇ ਨਾਲ ਕਿਸ ਤਰ੍ਹਾਂ ਕੀਤਾ ਜਾਵੇ ਉਸਦੇ ਵਿੱਚ ਜਿਹੜੇ ਵੀ ਟੋਪਿਕ ਹੁੰਦੇ ਹਨ ਉਹ ਬੱਚੇ ਨੂੰ ਉਸਦੇ ਮੋਬਾਇਲ ਦੇ ਵਿੱਚ ਦੱਸੇ ਜਾਣ ਕਿਉਂਕਿ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਕੋਈ ਸਮਝ ਨਹੀਂ ਹੁੰਦੀ ਅਤੇ ਫਿਰ ਉਹਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਮੋਬਾਈਲ ਹੈ ਤੈਨੂੰ ਅਸੀਂ ਤੇਰੀ ਵਿਦਿਆ ਦੇ ਵਿੱਚ ਉਤੇਜਤਾ ਲਈ ਦਿੱਤਾ ਹੈ ਤਾਂ ਕਿ ਤੂੰ ਅੱਛੇ ਅੱਛੇ ਟੋਪਿਕ ਸਰਚ ਕਰਕੇ ਇਸਨੂੰ ਮੱਦੇ ਨਜ਼ਰ ਰੱਖ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇਤ ਦਿਓ ਅਤੇ ਪੜ੍ਹਾਈ ਦੇ ਵਿੱਚ ਇੱਕ ਅੱਛਾ ਅਚੀਵਮੈਂਟ ਕਰ ਸਕਦੇ ਹੋ ਜੇ ਵੀ ਕੋਈ ਵੀ ਬੱਚਾ ਜਦੋਂ ਪੜ੍ਹਦਾ ਹੈ ਉਸ ਦੇ ਧਿਆਨ ਵਿੱਚ ਇਹ ਲਿਆਂਦਾ ਜਾਵੇ ਕਿ ਮੋਬਾਈਲ ਫੋਨ ਜਿਹੜਾ ਉਸਦੀ ਦੁਰਵਰਤੋਂ ਨਾ ਕੀਤੀ ਜਾਵੇ ਕਿਉਂਕਿ ਮੋਬਾਇਲ ਫੋਨ ਦੇ ਵਿੱਚ ਕੁਛ ਅੱਛੀਆਂ ਗੱਲਾਂ ਵੀ ਹੁੰਦੀਆਂ ਹੈ ਅਤੇ ਕੁਛ ਸਾਡੇ ਵਾਸਤੇ ਅਤੇ ਸਾਡੇ ਬੱਚਿਆਂ ਵਾਸਤੇ ਹਾਨੀਕਾਰਕ ਵੀ ਹੁੰਦੀਆਂ ਹਨ ਉਹ ਚੀਜ਼ਾਂ ਨੂੰ ਆਪਣੇ ਧਿਆਨ ਵੱਲ ਰੱਖਦਿਆਂ ਅਸੀਂ ਆਪਣੇ ਬੱਚੇ ਨੂੰ ਸੁਚਾਰੂ ਢੰਗ ਦੇ ਨਾਲ ਫੋਨ ਦੀ ਵਰਤੋਂ ਕਰਨ ਲਈ ਉਹਨਾਂ ਦੀ ਮਦਦ ਕਰ ਸਕਦੇ ਹਾਂ ਅਤੇ ਇੱਕ ਅੱਛੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣੇ ਬੱਚੇ ਨੂੰ ਅਸੀਂ ਮੋਬਾਇਲ ਫੋਨ ਦੇ ਨਾਲ ਨਾਲ ਉਸ ਨੂੰ ਅੱਛੀਆਂ ਗੱਲਾਂ ਦੇ ਨਾਲ ਵੀ ਸਮਝਾ ਸਕਦੇ ਹਾਂ ਕਿ ਮੋਬਾਇਲ ਫੋਨ ਦੀ ਵਰਤੋਂ ਸਿਰਫ਼ ਆਪਣੀ ਪੜ੍ਹਾਈ ਨਾਲ ਸੰਬੰਧਤ ਹੀ ਕੀਤੀ ਜਾਵੇ ਨਾ ਕਿ ਦੂਸਰੀਆਂ ਕੋਈ ਹੋਰ ਚੀਜ਼ਾਂ ਦੇ ਵੱਲ ਜਿਹੜੀਆਂ ਕਿ ਗਲਤ ਹੁੰਦੀਆਂ ਹਨ ਉਸ ਨਾਲ ਉਸ ਨੂੰ ਖ਼ਰਾਬੀ ਵੀ ਆ ਸਕਦੀ ਹੈ ਇਹ ਉਸ ਨੂੰ ਪਹਿਲਾਂ ਹੀ ਅੱਛੀ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਹੈ